ਪੰਜਾਬ ਵਿੱਚ ਤੁਹਾਨੂੰ ਕਾਫੀ ਸਾਰੇ ਕਲਾ ਦੇ ਤਿਉਹਾਰ ਜਾਂ ਸਗਾ ਸਮਾਗਮ ਦੇਖਣ ਨੂੰ ਮਿਲਣਗੇ ਜਿਹਦੇ ਵਿੱਚ ਬਹੁਤ ਸਾਰੇ ਜੋ ਸਗਾ ਸਮਾਗਮ ਨੇ ਕਾਫੀ ਛੋਟੇ ਪੱਧਰ 'ਤੇ ਵੀ ਹੁੰਦੇ ਨੇ ਅਤੇ ਕਈ ਬਹੁਤ ਵੱਡੇ ਪੱਧਰ 'ਤੇ ਵੀ ਹੁੰਦੇ ਨੇ ਦੇਖਿਆ ਜਾਵੇ ਤਾਂ ਇਹਦੇ ਵਿੱਚ ਚੰਡੀਗੜ੍ਹ ਸ਼ਹਿਰ ਦੇ ਵਿੱਚ ਕਲਾ ਦਾ ਸਮਾਗਮ ਹੁੰਦਾ ਹੈ ਜੋ ਕਿ ਕਾਫੀ ਨੈਸ਼ਨਲ ਲੈਵਲ 'ਤੇ ਤੁਹਾਨੂੰ ਦੇਖਣ ਤੋਂ ਮਿਲੇਗਾ ਇਹਦੇ ਵਿੱਚ ਪੰਜਾਬ ਤੋਂ ਹੀ ਨਹੀਂ ਬਲਕਿ ਆਸ ਪਾਸ ਦੇ ਜੋ ਵੀ ਰਾਜ ਨੇ ਉੱਥੋਂ ਵੀ ਲੋਕ ਇਸ ਕਲਾ ਨੂੰ ਦੇਖਣ ਲਈ ਆਉਂਦੇ ਨੇ ਇਸ ਤੋਂ ਇਲਾਵਾ ਜੇ ਦੇਖਿਆ ਜਾਵੇ ਤਾਂ ਰਾਸ਼ਟਰੀ ਤੌਰ ਤੋਂ ਇਲਾਵਾ ਅੰਤਰਰਾਸ਼ਟਰੀ ਫਿਲਮ ਬਸ ਜੋ ਨੇ ਪੰਜਾਬ ਦੇ ਵਿੱਚ ਫਿਲਮ ਫੈਸਟੀਵਲ ਤੁਹਾਨੂੰ ਦੇਖਣ ਨੂੰ ਮਿਲਣਗੇ ਜਿਹਦੇ ਵਿੱਚ ਨਾ ਕਿ ਸਿਰਫ ਦੇਸ਼ ਪਰ ਵਿਦੇਸ਼ ਤੋਂ ਵੀ ਲੋਕ ਇਸਦੇ ਵਿੱਚ ਹਿੱਸਾ ਲੈਂਦੇ ਨੇ ਫਿਰ ਇਸ ਤੋਂ ਬਾਅਦ ਆਪਾਂ ਦੇਖਿਆ ਜਾਵੇ ਤਾਂ ਇਸਦੇ ਵਿੱਚ ਪੰਜਾਬ ਦੇ ਹੀ ਫੌਕ ਫੈਸਟੀਵਲ ਜੋ ਇੱਥੋਂ ਦੇ ਨੋਰਮਲ ਜੋ ਇੱਥੋਂ ਦੀ ਜੋ ਇਸ ਦਾ ਇਤਿਹਾਸਿਕ ਜੋ ਸੱਭਿਆਚਾਰ ਹੈ ਉਸਨੂੰ ਪ੍ਰਦਰਸ਼ਿਤ ਕਰਦੇ ਹਨ ਇਸਦੇ ਵਿੱਚ ਬਹੁਤ ਸਾਰੇ ਲੋਕ ਹਿੱਸਾ ਲੈਂਦੇ ਹਨ ਉਸਨੂੰ ਦੇਖਣ ਲਈ ਉਸਨੂੰ ਸਮਝਣ ਲਈ ਬਹੁਤ ਸਾਰੇ ਲੋਕ ਨਾ ਕਿ ਸਿਰਫ ਪੰਜਾਬ ਤੋਂ ਹੀ ਬਟ ਭਾਰਤ ਦੇ ਵੱਖਰੇ ਵੱਖਰੇ ਰਾਜਾਂ ਤੋਂ ਵੀ ਇਸ ਚੀਜ਼ ਨੂੰ ਦੇਖਣ ਲਈ ਸਮਝਣ ਲਈ ਉੱਥੇ ਪਹੁੰਚਦੇ ਹਨ ਅਤੇ ਇਸ ਤਰ੍ਹਾਂ ਇਹ ਕਾਫੀ ਸਾਰੇ ਜਿਵੇਂ ਲੋਕ ਉੱਥੇ ਪਹੁੰਚਣਗੇ ਦੇਖਣਗੇ ਜਾਣਨਗੇ ਕਿ ਪੰਜਾਬ ਦਾ ਜੋ ਵੀ ਇਤਿਹਾਸ ਹੈ ਦੇਖ ਕੇ ਤੁਹਾਨੂੰ ਪਤਾ ਲੱਗੇਗਾ ਕਿ ਕਿਸ ਤਰ੍ਹਾਂ ਪੰਜਾਬ ਨੇ ਪੂਰੇ ਦੇਸ਼ ਨੂੰ ਪੰਜਾਬ ਦੇ ਇਤਿਹਾਸ ਨੇ ਪੂਰੇ ਦੇਸ਼ ਨੂੰ ਕਿਵੇਂ ਪ੍ਰਭਾਵਿਤ ਕੀਤਾ ਹੈ